ਜਦੋਂ ਮੈਂ ਸਟਾਰਟਿੰਗ ਦੇ ਵਿੱਚ ਬਾਈਕ ਸਿੱਖਣੀ ਸ਼ੁਰੂ ਕੀਤੀ ਤਾਂ ਮੈਨੂੰ ਸਿੱਖਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਜਿਵੇਂ ਕਿ ਉਹਦੇ ਬਹੁਤ ਸਾਰੀਆਂ ਬਰੇਕਾਂ ਹੁੰਦੀਆਂ ਨੇ ਕਲੱਚ ਹੁੰਦੇ ਨੇ ਬਹੁਤ ਜਿਆਦੇ ਉਹਦੇ ਬਹੁਤ ਜਿਆਦੇ ਉਹਦੇ ਗੇਅਰ ਵਗੈਰਾ ਹੁੰਦੇ ਨੇ ਜਿਹੜੇ ਕਿ ਬਹੁਤ ਮੁਸ਼ਕਿਲ ਨਾਲ ਪਤਾ ਲੱਗਦੇ ਨੇ ਵੀ ਕਿਵੇਂ ਕਿਵੇਂ ਕਿਦਾਂ ਕਰਕੇ ਹੁੰਦੇ ਨੇ ਤਾਂ ਸਟਾਰਟਿੰਗ ਦੇ ਵਿੱਚ ਮੈਨੂੰ ਮੇਰੇ ਪਾਪਾ ਨੇ ਬ ਬਾਈਕ ਸਿਖਆਉਣੀ ਸ਼ੁਰੂ ਕੀਤੀ ਸੀਗੀ ਮੈਂ ਬਹੁਤ ਵਾਰੀ ਡਿੱਗੀ ਵੀ ਆ ਬਾਈਕ ਸਿੱਖਦੀ ਹੋਈ ਕਦੇ ਰੇਸ ਜਿਆਦੇ ਹੋ ਜਾਂਦੀ ਸੀ ਕਦੇ ਬਰੇਕ ਗਲਤ ਲੱਗ ਜਾਂਦੀ ਸੀ ਕਦੇ ਕਲਚ ਸਹੀ ਨਹੀਂ ਸੀ ਹੁੰਦਾ ਤੇ ਇਹਦੇ ਕਰਕੇ ਵੀ ਬਹੁਤ ਜਿਆਦਾ ਮੁਸ਼ਕਿਲਾਂ ਆਉਂਦੀਆਂ ਨੇ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਸਿੱਖਦੇ ਆਂ ਤਾਂ ਡਿੱਗਣ ਨਾਲ ਸੱਟਾਂ ਵੀ ਵੱਜਦੀਆਂ ਨੇ ਕਈ ਵਾਰ ਨਹੀਂ ਧਿਆਨ ਦੇ ਵਿੱਚ ਰਹਿੰਦਾ ਵੀ ਬਾਈਕ ਦੀ ਕਲੱਚ ਵੀ ਨੱਪਣੀ ਆ ਜਾਂ ਬਰੇਕ ਰੇਸ ਵੀ ਕਿੱਦਾਂ ਕਰਕੇ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਜਮਾ ਨਹੀਂ ਪਤਾ ਲੱਗਦਾ ਕਿਉਂਕਿ ਹੋਲੀ ਹੋਲੀ ਕਰਕੇ ਸਿਖਿਆ ਜਾਂਦਾ ਤੇ ਇਹ ਚੀਜ਼ਾਂ ਮਤਲਬ ਇੱਕ ਵਾਰੀ ਤਾਂ ਪਹਿਲਾਂ ਤਾਂ ਖੁੱਲੇ ਥਾਂ ਤੇ ਸਿੱਖਣੀਆਂ ਪੈਂਦੀਆਂ ਜਿੱਥੇ ਕੋਈ ਟਰੈਫਿਕ ਵਗੈਰਾ ਨਾ ਹੋਵੇ ਜਦੋਂ ਆਪਾਂ ਉੱਥੇ ਪ੍ਰੋਪਰ ਪ੍ਰਪੇਅਰ ਹੋ ਜਾਣੇ ਆ ਸਿੱਖ ਜਾਨੇ ਆ ਬਾਈਕ ਵੀ ਚੰਗੀ ਤਰ੍ਹਾਂ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਬਰੇਕ ਦਾ ਕਲੱਚ ਦਾ ਸਾਰਾ ਕੁਝ ਰੇਸ ਵਗੈਰਾ ਸਭ ਕੁਝ ਪਤਾ ਲੱਗਣ ਲੱਗ ਜਾਂਦਾ

ਲੱਗ ਸਕਦੀ ਆ ਤੇ ਦੂਜੀ ਗੱਲ ਹੈ ਕਿ ਜਿਹੜੇ ਟਰੈਫਿਕ ਦੇ ਨਿਯਮ ਹੁੰਦੇ ਨੇ ਜਿੱਦਾਂ ਕਿ ਬੱਤੀਆਂ ਹੁੰਦੀਆਂ ਨੇਗੀਆਂ ਲਾਈਟਸ ਹੁੰਦੀਆਂ ਰੈਡ ਲਾਈਟ ਗਰੀਨ ਲਾਈਟ ਯੈਲੋ ਲਾਈਟ ਰੈਡ ਲਾਈਟ ਨਾਲ ਤਾਂ ਆਪਾਂ ਨੂੰ ਰੁਕਣ ਦਾ ਸੰਕੇਤ ਦਿੰਦੀ ਐ ਯੈਲੋ ਲਾਈਟ ਤਿਆਰ ਹੋਣ ਦਾ ਤੇ ਗਰੀਨ ਲਾਈਟ ਆਪਾਂ ਨੂੰ ਚੱਲਣ ਦਾ ਸੰਦੇਸ਼ ਦਿੰਦੀ ਐ ਤੇ ਆਪਾਂ ਨੂੰ ਇਨਾਂ ਚੀਜਾਂ ਦੀ ਵੀ ਪਾਲਨਾ ਕਰਨੀ ਚਾਹੀਦੀ ਆ ਇਹ ਨਿਯਮ ਵੀ ਜਰੂਰੀ ਨੇ ਕਿਉਂਕਿ ਇਹਨਾਂ ਨਿਯਮਾਂ ਕਰਕੇ ਐਕਸੀਡੈਂਟ ਦੀਆਂ ਦੁਰਘਟਨਾਵਾਂ ਘਟ ਜਾਂਦੀਆਂ ਨੇ ਜਿਹਨਾਂ ਕਰਕੇ ਮਤਲਬ ਰੋਡ ਤੇ ਦੁਰਘਟਨਾਵਾਂ ਘੱਟ ਹੁੰਦੀਆਂ ਅਸੀਂ ਸੱਟਾਂ ਤੋਂ ਵੀ ਬਚ ਜਾਂਨੇ ਆ ਅਗਰ ਅਸੀਂ ਜੇਕਰ ਇਹਨਾਂ ਨਿਯਮਾਂ ਦੀ ਨਹੀਂ ਪਾਲਣਾ ਕਰਦੇ ਤਾਂ ਫਿਰ ਅਸੀਂ ਸੱਟਾਂ ਸਾਡੇ ਲੱਗ ਜਾਂਦੀਆਂ ਨੇ ਤੇ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਜਿਨਾਂ ਕਰਕੇ ਸਾਨੂੰ ਕੱਲੀਆਂ ਬਾਹਰੀ ਨੀ ਅੰਦਰੂਨੀ ਸੱਟਾਂ ਵੀ ਲੱਗ ਜਾਂਦੀਆਂ ਜਿਹੜੀਆਂ ਕੀ ਸਾਡੀ ਸਿਹਤ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ ਤੇ ਇਸ ਨਾਲ ਜਾਨ ਵੀ ਚਲੀ ਜਾ ਸਕਦੀ ਹੈ ਦੁਰਘਟਨਾ ਦੇ ਵਿੱਚ ਕਿਉਂਕਿ ਨਹੀਂ ਪਤਾ ਹੁੰਦਾ ਕਦੋਂ ਕਿਸ ਟਾਈਮ ਕੀ ਹੋ ਸਕਦਾ ਤੇ ਇਸ ਲਈ ਸਾਨੂੰ ਨਿਯਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਆ ਤੇ ਬਾਕੀ ਬਾਈਕ ਸਿੱਖਣ ਵੇਲੇ ਬਸ ਧਿਆਨ ਨਾਲ ਸਿੱਖਣੀ ਚਾਹੀਦੀ ਆ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ